ਜਦੋਂ ਮੈਂ ਪਹਿਲੀ ਵਾਰੀ ਖਾਣਾ ਬਣਾਉਣਾ ਸ਼ੁਰੂ ਕੀਤਾ ਉਦੋਂ ਮੈਂ ਪੰਦਰਾਂ ਸੋਲ੍ਹਾਂ ਸਾਲ ਦੀ ਸੀ ਮੇਰੇ ਮੰਮੀ ਥੋੜ੍ਹਾ ਜਿਹਾ ਬਿਮਾਰ ਰਹਿੰਦੇ ਸੀ ਉਹਦੇ ਕਰਕੇ ਮੈਨੂੰ ਮੈਂ ਛੋਟੀ ਉਮਰ ਦੇ ਵਿੱਚ ਹੀ ਰੋਟੀ ਸਬਜ਼ੀ ਸਾਰਾ ਕੁਛ ਬਣਾਉਣਾ ਸਿੱਖ ਲਿਆ ਸੀ ਅਤੇ ਜਦੋਂ ਮੈਂ ਪਹਿਲੀ ਵਾਰੀ ਰੋਟੀ ਬਣਾਈ ਤਾਂ ਉਦੋਂ ਸਹੀ ਨਹੀਂ ਬਣਦੀ ਸੀ ਤਾਂ ਫਿਰ ਮੈਂ ਹੌਲ਼ੀ ਹੌਲ਼ੀ ਕਰਕੇ ਸਾਰਾ ਕੁਛ ਸਿੱਖਿਆ ਮੇਰੇ ਮੰਮੀ ਨੇ ਮੈਨੂੰ ਸਿਖਾਇਆ ਅਤੇ ਅੱਜ ਮੈਂ ਹਰ ਇੱਕ ਚੀਜ਼ ਬਹੁਤ ਹੀ ਵਧੀਆ ਤਰੀਕੇ ਨਾਲ਼ ਬਣਾ ਲੈਂਦੀ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਕੁਕਿੰਗ ਕਰਨਾ ਅਤੇ ਮੈਂ ਫ਼ੋਨ ਦੇ ਵਿੱਚ ਵੀ ਰੈਸੀਪੀਜ਼ ਦੇਖਦੀ ਹਾਂ ਅਤੇ ਮੈਂ ਟੀ ਵੀ ਦੇ ਵਿੱਚ ਵੀ ਦੇਖਦੀ ਹਾਂ ਅਤੇ ਮੈਂ ਆਪਣੀ ਫੈਮਿਲੀ ਨੂੰ ਸਾਰਾ ਕੁਛ ਬਣਾ ਕੇ ਖਵਾਉਂਦੀ ਹਾਂ ਅਤੇ ਸਾਰੇ ਜਣੇ ਬਹੁਤ ਪਸੰਦ ਕਰਦੇ ਆ